ਸਾਡੇ ਖੇਤਰ ਵਿੱਚ ਆਮ ਸਿਹਤ ਸਮੱਸਿਆ ਇਹ ਹੈਗੀ ਇੱਥੇ ਬਹੁਤ ਜ਼ਿਆਦਾ ਗੰਦਗੀ ਹੈਗੀ ਹੈ ਰੋਜ਼ ਲੋਕ ਇੱਥੇ ਖਾਲੀ ਪਲਾਟ ਪਏ ਆ ਅਤੇ ਲੋਕ ਕੂੜਾ ਸੁੱਟ ਸੁੱਟ ਜਾਂਦੇ ਹਨ ਉਹਦੇ ਨਾਲ ਮੱਛਰ ਮੱਖੀਆਂ ਅਤੇ ਬਿਮਾਰੀਆਂ ਬਹੁਤ ਜ਼ਿਆਦਾ ਬਿਮਾਰੀਆਂ ਫੈਲੀ ਜਾਂਦੀਆਂ ਹੈਗੀਆਂ ਮੱਛਰ ਮੱਖੀਆਂ ਨਾਲ ਅਤੇ ਕੂੜਾ ਕਰਕਟ ਨਾਲ ਅਤੇ ਗੰਦਾ ਗੰਦਾ ਪਾਣੀ ਵੀ ਇਥੇ ਨਿਕਲਦਾ ਰਹਿੰਦਾ ਉਹਦੇ ਨਾਲ ਵੀ ਮੱਛਰ ਹੋ ਜਾਂਦਾ ਹੈਗਾ ਉਹਦੇ ਨਾਲ ਮਲੇਰੀਆ ਬੁਖਾਰ ਲੋਕਾਂ ਨੂੰ ਹੋ ਜਾਂਦਾ ਹੈ ਘ ਜਾਂ ਡੇਂਗੂ ਹੋ ਜਾਂਦਾ ਹੈਗਾ ਡੇਂਗੂ ਬੁਖਾਰ ਹੋ ਜਾਂਦਾ ਸ ਕਈ ਲੋਕਾਂ ਨੂੰ ਸਕਿੰਨ ਪ੍ਰੋਬਲਮ ਵੀ ਹੋਈ ਪਈ ਹੈ ਸਕਿੰਨ ਪ੍ਰੋਬਲਮ ਜੇ ਕਿਸੇ ਨੂੰ ਵੀ ਸਕਿੰਨ 'ਤੇ ਕੋਈ ਇਹੋ ਜਿਹੀ ਪ੍ਰੋਬਲਮ ਚਮੜੀ ਦੀ ਚ ਚਮੜੀ ਦੀ ਬਿਮਾਰੀਆਂ ਲੱਗੀ ਜਾਂਦੀਆਂ ਹੈ ਜਿਹੜੀ ਇੱਕ ਦੂਜੇ ਨੂੰ ਛੂਹਣ ਨਾਲ ਮਤਲਬ ਇੱਕ ਦੂਜੇ ਨੂੰ ਟ ਆਪਾਂ ਛੂਹਨੇ ਹਾਂ ਜਾਂ ਟੱਚ ਕਰਦੇ ਹਾਂ ਤਾਂ ਉਹਦੇ ਨਾਲ ਵੀ ਬਿਮਾਰੀ ਫੈਲਦੀ ਹੈਗੀ ਹੈ ਔਰ ਆਈ ਫਲੂ ਦੀ ਬਿ ਬਿਮਾਰੀ ਹੋਈ ਪਈ ਹੈ ਉਹਦੇ ਨਾਲ ਵੀ ਐਵੇਂ ਆ ਉਹ ਅੱਖਾਂ 'ਤੇ ਹੁੰਦਾ ਅੱਖਾਂ 'ਤੇ ਅਸਰ ਹੁੰਦਾ ਹੈ ਜੇ ਇੱਕ ਦੂਜੇ ਨੂੰ ਦੇਖ ਲੈਂਦੇ ਹਾਂ ਤਾਂ ਚਾਹੇ ਇੱਕ ਦੂਜੇ ਨੂੰ ਹੱਥ ਲਗਾ ਲੈਂਦੇ ਹਾਂ ਤਾਂ ਉਹ ਇੱਕ ਦੂਜੇ ਤੋਂ ਫੈਲਦਾ ਹੈਗਾ ਉਹ ਤੇ ਕੁਪੋਸ਼ਣ ਵੀ ਹੈਗਾ ਹੈ ਵੀ ਜੇ ਵਧੀਆ ਖੁਰਾਕ ਨਹੀਂ ਹੁੰਦੀ ਤਾਂ ਬ ਬੱਚਿਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈਗੀ ਆ ਉਹਦੇ ਨਾਲ ਖੂਨ ਦੀ ਕਮੀ ਕੈਲਸ਼ੀਅਮ ਦੀ ਕਮੀ ਜਿਹਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਇਹ ਬਿਮਾਰੀਆਂ ਲੱਗ ਜਾਂਦੀਆਂ ਹਨ ਉਹਨਾਂ ਦਾ ਗਰੋਥ ਉਹਨਾਂ ਦੀ ਰੁਕ ਜਾਂਦੀ ਹੈਗੀ ਆ ਬੱਚਿਆਂ ਦੀ ਉਹਨਾਂ ਦੀ ਗਰੋ